ਹਾਂ ਵੱਖ ਵੱਖ ਰੋਸ਼ਨੀ ਰੋਸ਼ਨ ਦੀਆਂ ਸਥਿਤੀਆਂ ਵਿੱਚ ਸ਼ੂਟਿੰਗ ਕਰਨ ਨਾਲ ਫੋਟੋ ਦਾ ਮੂਡ ਅਤੇ ਮਹੌਲ ਬਹੁਤ ਪ੍ਰਾ ਪ੍ਰਭਾਵਿਤ ਹੋ ਜਾਂਦਾ ਹੁੰਦਾ ਹੈ ਅਤੇ ਜਿਵੇਂ ਕਿ ਨਰਮ ਅਤੇ ਕੁਦਰਤੀ ਰੋਸ਼ਨੀ ਤਸਵੀਰ ਨੂੰ ਗਰਮ ਅਤੇ ਸੁੰਦਰ ਦਿਖਾਉਂਦੀ ਹੈ ਜਦੋਂ ਕਿ ਤੇਜ਼ ਅਤੇ ਕੜ ਕੜਕ ਰੋਸ਼ਨੀ ਨਾ ਨਾਟਕ ਨਾਟਕੀਅਤ ਵਧਾ ਸਕਦੀ ਹੈ ਰਾਤ ਦੀ ਹਲਕੀ ਰੋਸ਼ਨੀ ਇਕ ਤਸਵੀਰ ਨੂੰ ਸ਼ਾਤ ਅਤੇ ਰਹੱਸਮਈ ਬਣਾ ਸਕਦੀ ਹੈ ਜਦੋਂ ਕਿ ਸਾਨੂੰ ਪਤਾ ਹੈ ਕਿ ਯੁਕ ਵਾਲੀ ਰੌਸ਼ਨੀ ਤੇਜ਼ ਅਤੇ ਸਪੱਸ਼ਟ ਲਗ ਲੱਗਦੀ ਹੈ ਇਸ ਲਈ ਰੌਸ਼ਨੀ ਦੀ ਚੋਣ ਫੋਟੋਗ੍ਰਾਫੀ ਵਿੱਚ ਬਹੁਤ ਮਹੱਤਵਪੂਰਨ ਹੁੰਦੀ ਹੈ ਅੱਜ ਕੱਲ੍ਹ ਇਸ ਪੰਜਾਬ ਵਿੱਚ ਧੰਨਵਾਦ